ਮੇਰੀ ਨਜ਼ਰ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਕਾਰੋਬਾਰੀ ਲੋਕ ਹਨ ਜਿਹਨਾਂ ਨੇ ਬਹੁਤ ਪਹਿਲਾਂ ਬਹੁਤ ਲਾਭ ਕਮਾਇਆ ਅਤੇ ਹੁਣ ਉਹ ਕੰਗਾਲ ਹੋ ਗਏ ਹਨ ਉਹਨਾਂ ਦੀ ਕੰਗਾਲ ਹੋਣ ਅਤੇ ਡੁੱਬਣ ਦਾ ਇੱਕੋ ਇੱਕ ਕਾਰਨ ਉਹਨਾਂ ਦੇ ਬੱਚੇ ਹਨ ਸਾਡੀ ਆਪਣੇ ਏਰੀਏ ਦੇ ਵਿੱਚ ਇੱਕ ਬਹੁਤ ਹੀ ਨਾਮਦਾਰ ਅਤੇ ਤਜਰਬੇਦਾਰ ਇਨਸਾਨ ਹੈ ਜਿਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਸ ਇਨਸਾਨ ਦੀ ਬਹੁਤ ਸਾਰੇ ਪਲੋਟ ਦੁਕਾਨਾਂ ਅਤੇ ਬਹੁਤ ਸਾਰੀ ਪ੍ਰੋਪਰਟੀ ਸੀ ਜਿਸ ਨੂੰ ਉਸਨੇ ਬਹੁਤ ਹੀ ਮਿਹਨਤ ਨਾਲ ਕਮਾਇਆ ਸੀ ਪਰ ਜਦੋਂ ਉਸਦੇ ਬੱਚੇ ਉੱਠ ਖੜ੍ਹੇ ਅਤੇ ਉਸਦੇ ਬੱਚਿਆਂ ਹੱਥ ਵਿੱਚ ਉਸਨੇ ਆਪਣੇ ਕਾਰੋਬਾਰ ਦੀ ਡੋਰ ਦਿੱਤੀ ਅਤੇ ਉਸਦੇ ਬੱਚਿਆਂ ਨੇ ਉਸਦਾ ਕਾਰੋਬਾਰ ਡੁਬਾ ਦਿੱਤਾ ਕਿਉਂਕਿ ਉਸ ਦੇ ਬੱਚੇ ਜ਼ਿਆਦਾਤਰ ਨਸ਼ੇ ਵੱਲ ਲੱਗ ਗਏ ਸਨ ਕਿਉਂਕਿ ਬਾਪ ਦੀ ਕਮਾਈ ਉਹਨਾਂ ਨੂੰ ਹਾਜ਼ਮ ਨਹੀਂ ਆਈ ਅਤੇ ਉਸ ਉਹਨਾਂ ਨੇ ਆਪਣੀ ਬਜ਼ੁਰਗਾਂ ਦੀ ਕਮਾਈ ਨੂੰ ਨਸ਼ਿਆਂ ਵਿੱਚ ਲਗਾ ਦਿੱਤਾ ਅਤੇ ਹੌਲੀ ਹੌਲੀ ਕਰਕੇ ਜੋ ਵੀ ਜ਼ਮੀਨ ਜਾਇਦਾਦ ਸੀ ਉਹ ਸਭ ਵੇਚ ਦਿੱਤੀ ਅਤੇ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਕਾਰੋਬਾਰ ਡੁੱਬਣ ਦਾ ਇਹ ਹੈ ਕਿ ਉਹਨਾਂ ਦੇ ਬੱਚੇ ਨਸ਼ੇ ਵੱਲ ਵੱਧਦੇ ਜਾ ਰਹੇ ਸਨ ਅਤੇ ਸਭ ਜ਼ਰ ਜ਼ਮੀਨ ਜਾਇਦਾਦ ਨੂੰ ਵੇਚ ਕੇ ਖਾ ਗਏ